ਸੁਰੱਖਿਆ ਅਤੇ ਅਰਾਮ ਲਈ ਵੱਖ ਵੱਖ ਮੌਸਮ ਦੀਆਂ ਸਥਿਤੀਆਂ ਵਿੱਚ ਦੌੜਨ ਲਈ ਕੁਝ ਤਬਦੀਲੀਆਂ ਦੀ ਲੋੜ ਹੁੰਦੀ ਆ ਜਿਵੇਂ ਗਰਮ ਠੰਢੇ ਅਤੇ ਬਰਸਾਤੀ ਮੌਸਮ ਵਿੱਚ ਦੌੜਨ ਲਈ ਕੁਝ ਜ਼ਰੂਰੀ ਸੁਝਾਅ ਐ ਹੈ ਜਿਵੇਂ ਕਿ ਆਪਣਾ ਗਰਮ ਮੌਸਮ ਦੇ ਉੱਤੇ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਬਈ ਡੀਹਾਈਡ੍ਰੇਸ਼ਨ ਨੂੰ ਰੋਕਣ ਲਈ ਆਪਣੀ ਦੌੜ ਤੋਂ ਪਹਿਲਾਂ ਦੌੜਨ ਅਤੇ ਬਾਅਦ ਵਿੱਚ ਬਹੁਤ ਸਾਰਾ ਪਾਣੀ ਪੀਓ ਅਤੇ ਦੂਜਾ ਬਈ ਸਹੀ ਸਮੇਂ ਚੁਣੋ ਸਵੇਰ ਜਾਣ ਸਵੇਰ ਜਾਓ ਸਵੇਰੇ ਸਵੇਰੇ ਜਾਂ ਫਿਰ ਤੁਸੀਂ ਸ਼ਾਮੀ ਜਾਓ ਆਪਣੀ ਦੌੜ ਦੀ ਯੋਜਨਾ ਬਣਾਓ ਇੱਦਾਂ ਜਦੋਂ ਤਾਪਮਾਨ ਠੰਢਾ ਹੁੰਦਾ ਹੈ ਤੀਜੀ ਸਮਝਦਾਰੀ ਨਾਲ ਕੱਪੜੇ ਪਾਓ ਅਤੇ ਬਈ ਸਿਰ ਦੇ ਸਰੀਰ ਦੇ ਤਾਪਮਾਨ ਦੇ ਹਿਸਾਬ ਨਾਲ ਨਿਯੰਤਰਿਤ ਕਰਨ ਲਈ ਹਲਕੇ ਨਮੀ ਵਾਲੇ ਕੱਪੜਿਆਂ ਦੀ ਚੋਣ ਕਰੋ ਅਤੇ ਚੌਥਾ ਹੈਗਾ ਬਈ ਆਪਣਾ ਸੂਰਜ ਦੀ ਸੁਰੱਖਿਆ ਦਾ ਵੀ ਧਿਆਨ ਰੱਖੋ ਬਈ ਆਪਣੀ ਚਮੜੀ ਨੂੰ ਯੂ ਵੀ ਕ੍ਰਿਰਨਾ ਤੋਂ ਬਚਾਉਣ ਲਈ ਟੋਪੀ ਸਨ ਗਲਾਸਿਸ ਅਤੇ ਸਨਸਕ੍ਰੀਮ ਦੀ ਵਰਤੋਂ ਵੀ ਵਰਤੋਂ ਅਤੇ ਪੰਜਵਾਂ ਆਪਣੇ ਬਈ ਗਰਮੀ ਨਾਲ ਜੁੜੇ ਲੱਛਣਾਂ ਤੋਂ ਸੁਚੇਤ ਰਹੋ ਅਤੇ ਜੇ ਲੋੜ ਪਵੇ ਤਾਂ ਜ਼ਰੂਰੀ ਅਰਾਮ ਲਓ ਅਤੇ ਇਹ ਤਾਂ ਹੋ ਗਿਆ ਗਰਮੀ ਵਾਲਾ ਮੌਸਮ ਅਤੇ ਦੂਜਾ ਫਿਰ ਆਪਣਾ ਠੰਢਾ ਮੌਸਮ ਜਿਵੇਂ ਕਿ ਅਸੀਂ ਜਾਣਦੇ ਹਾਂ ਵੀ ਠੰਢ ਵਿੱਚ ਆਪਾਂ ਨੂੰ ਗਰਮੀ ਬਰਕਰਾਰ ਰੱਖਣੀ ਚਾਹੀਦੀ ਆ ਤਾਂ ਉਹਦੇ ਕਰਕੇ ਆਪਾਂ ਨੂੰ ਚਾਹੀਦਾ ਕਿ ਬਈ ਪਰਤਾਂ ਵਿੱਚ ਕੱਪੜੇ ਪਾਵੇ ਬੰਦਾ ਅਤੇ ਦੂਜੀ ਉਹੀ ਚੰਗੀ ਤਰ੍ਹਾਂ ਵਾਰਮ ਅੱਪ ਕਰਨਾ ਚਾਹੀਦਾ ਕਿ ਜੇ ਕਿਸੇ ਸੱਟ ਤੋਂ ਬਚਣ ਲਈ ਲੰਬੇ ਸਮੇਂ ਤੱਕ ਵੋਰਮ ਅੱਪ ਦੀ ਲੋੜ ਪੈ ਸਕਦੀ ਆ ਅਤੇ ਤੀਜਾ ਆਪਣੇ ਹੱਥਾਂ ਨੂੰ ਸਿਰ ਅਤੇ ਪੈਰਾਂ ਨੂੰ ਦਸਤਾਨੇ ਟੋਪੀ ਅਤੇ ਥਰਮਲ ਜੁਰਾਬਾਂ ਨਾਲ ਸੁਰੱਖਿਅਤ ਕਰੋ ਅਤੇ ਚੌਥਾ ਹੈਗਾ ਬਈ ਠੰਢ ਵਿੱਚ ਧਿਆਨ ਰੱਖੋ ਆਪਣੇ ਠੰਢ ਦੇ ਹਿਸਾਬ ਨਾਲ ਆਪਣਾ ਰਸਤਾ ਅਤੇ ਗਤੀ ਅਨੁਕੂਲ ਕਰੋ ਅਤੇ ਪੰਜਵਾਂ ਕਿ ਦਿਖਾਈ ਦਿੰਦੇ ਰਹੋ ਬਈ ਦਿਨ ਦੀ ਰੋਸ਼ਨੀ ਅਤੇ ਘੱਟ ਸਮੇਂ ਦੌਰਾਨ ਦੇਖਣ ਲਈ ਪ੍ਰਤੀਬਿੰਬਤ ਕੱਪੜੇ ਪਾਓ ਅਤੇ ਜਿਵੇਂ ਆਪਣਾ ਬਰਸਾਤੀ ਮੌਸਮ ਹੋ ਗਿਆ ਹੈ ਤਾਂ ਉਹਦੇ 'ਚ ਆਪਾਂ ਨੂੰ ਚਾਹੀਦਾ ਕਿ ਬਈ ਕੋਈ ਵਾਟਰ ਪ੍ਰੂਫ ਪਾਣੀ ਪ੍ਰਤੀਰੋਧਕ ਕੱਪੜਾ ਪਾਓ ਜਿਸ ਵਿੱਚ ਜੈਕਟਾਂ ਪੈਂਟ ਅਤੇ ਜੁੱਤੀਆਂ ਸ਼ਾਮਿਲ ਹਨ ਅਤੇ ਦੂਜਾ ਇਹੋ ਜਿਹੇ ਕੱਪੜਿਆਂ ਦੀ ਚੋਣ ਕਰੋ ਜਿਹੜੇ ਬਿਮਾਰੀ ਨੂੰ ਰੋਕਣ ਲਈ ਹੁੰਦੇ ਆ ਅਤੇ ਚੌਥਾ ਬਈ ਆਪਣਾ ਆਪਣੇ ਫੋਨ ਅਤੇ ਹੋਰ ਇਲੈਕਟਰੋਨਿਕਸ ਨੂੰ ਵਾਟਰਪ੍ਰੂਫ ਕਿਸੇ ਥਾਂ ਵਿੱਚ ਸਟੋਰ ਕਰੋ ਅਤੇ ਆਪਾਂ ਨੂੰ ਚਾਹੀਦਾ ਇੱਦਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਮੌਸਮ ਦੇ ਹਿਸਾਬ ਨਾਲ ਆਪਾਂ ਨੂੰ ਚੱਲਣਾ ਪੈਂਦਾ ਹੈ